ਵੈਸੇ ਤਾਂ ਮੈਂ ਬਹੁਤ ਜ਼ਿਆਦਾ ਘੁੰਮਣ ਦਾ ਸ਼ੌਕੀਨ ਹਾਂ ਅਤੇ ਮੈਂ ਬਹੁਤ ਜ਼ਿਆਦਾ ਯਾਤਰਾ ਕੀਤੀ ਆ ਕੀਤੀਆਂ ਹੈ ਅਤੇ ਜਿਵੇਂ ਕਿ ਜੋ ਮੇਰੀ ਸਭ ਤੋਂ ਵਧੀਆ ਯਾਤਰਾ ਸੀ ਉਹ ਸੀਗੀ ਜੀ ਕਸ਼ਮੀਰ ਦੀ ਮੈਨੂੰ ਜਿਵੇਂ ਕੀ ਫਿਲਮਾਂ ਵਿੱਚ ਦਿਖਾਇਆ ਜਾਂਦਾ ਹੈ ਕੀ ਉੱਥੇ ਦਾ ਮਾਹੌਲ ਜਿਹੜਾ ਹੈ ਬਹੁਤ ਜਿਆਦਾ ਵਧੀਆ ਨਹੀਂ ਹੈ ਆਰਮੀ ਦਾ ਆਰਮੀ ਰਹਿੰਦੀ ਹੈ ਉੱਥੇ ਪਰ ਜਿਵੇਂ ਕਿ ਉੱਥੇ ਪਰ ਜਦ ਅਸੀਂ ਉੱਥੇ ਪਹੁੰਚੇ ਤਾਂ ਉੱਥੇ ਦਾ ਮਾਹੌਲ ਦੇਖਿਆ ਜਿਹੜੇ ਉੱਥੇ ਦੇ ਲੋਕ ਸੀਗੇ ਬਹੁਤ ਵਧੀਆ ਸੀਗੇ ਅਤੇ ਉੱਥੇ ਦੀਆਂ ਜਿਹੜੀਆਂ ਆਬਾਦੀਆਂ ਸੀਗੀਆਂ ਉਹਨਾਂ ਜਿਹੜਾ ਦ੍ਰਿਸ਼ ਸੀਗਾ ਬਹੁਤ ਸੋਹਣਾ ਸੀਗਾ ਅਤੇ ਜਿੰਨੇ ਕੁ ਸਾਡੇ ਜਿੰਨਾ ਕੁ ਸਾਡਾ ਖਰਚਾ ਹੋਇਆ ਸੀਗਾ ਜੀ ਉਹ ਖਰਚੇ ਦੇ ਵਿੱਚ ਉਹ ਮੇਰਾ ਹੁਣ ਤੱਕ ਦੀ ਸਭ ਤੋਂ ਵਧੀਆ ਯਾਤਰਾ ਸੀਗੀ ਅਤੇ ਇਹ ਵੀ ਮੈਂ ਆਪਣੇ ਦੋਸਤਾਂ ਨਾਲ ਕੀਤੀ ਸੀਗੀ ਜੀ ਇਹ ਅਸੀਂ ਐਥੋਂ ਟ੍ਰੇਨ 'ਚ ਗਏ ਸੀਗੇ ਜੀ ਜੰਮੂ ਤੱਕ ਫੇਰ ਜੰਮੂ ਤੋਂ ਅਸੀਂ ਬੱਸ ਦੇ ਵਿੱਚ ਇਹ ਸਫਰ ਕੀਤਾ ਕਸ਼ਮੀਰ ਤੱਕ ਦਾ ਅਤੇ ਉੱਥੇ ਜਾ ਕੇ ਅਸੀਂ ਇੱਕ ਬੋਟ ਹਾਊਸ ਸੀਗਾ ਜੀ ਉਹਦੇ ਵਿੱਚ ਰੁਕੇ ਜੋ ਕੀ ਉੱਥੇ ਦੀ ਬਹੁਤ ਪ੍ਰਸਿੱਧ ਡੱਲ ਲੇਕ ਹੈਗੀ ਹੈ ਉਹਦੇ ਵਿੱਚ ਆਪਾਂ ਨੂੰ ਇੱਕ ਕਿਸ਼ਤੀ ਦੇ ਵਿੱਚ ਘਰ ਬਣਿਆ ਹੁੰਦਾ ਹੈ ਉਹਦੇ ਉਹਨੂੰ ਅਸੀਂ ਬੁੱਕ ਕਰ ਲਿਆ ਸੀਗਾ ਜੀ ਚਾਰ ਦਿਨਾਂ ਵਾਸਤੇ ਚਾਰ ਦਿਨਾਂ ਵਾਸਤੇ ਅਸੀਂ ਚਾਰ ਦੋਸਤ ਸੀਗੇ ਜੀ ਸਾਡਾ ਤਕਰੀਬਨ ਉਹਦੇ 'ਤੇ ਬਾਰਾਂ ਕੁ ਹਜ਼ਾਰ ਦਾ ਖਰਚਾ ਆਇਆ ਜੀ ਚਾਰ ਦਿਨਾਂ ਦਾ ਜਿਹਦੇ ਵਿੱਚ ਸਾਨੂੰ ਸਵੇਰ ਦਾ ਅਤੇ ਸ਼ਾਮ ਦਾ ਭੋਜਨ ਵੀ ਵਿੱਚੇ ਸੀਗਾ ਅਤੇ ਭੋਜਨ ਵਿੱਚ ਸੀਗਾ ਜੀ ਉਹਤੋਂ ਬਾਅਦ ਉਹ ਸ਼ਾਮ ਨੂੰ ਸਾਨੂੰ ਲੇਕ ਦੇ ਵਿੱਚੋਂ ਜਿਹੜੀ ਬੋਟ ਸੀਗੀ ਉਹਨੂੰ ਘੁਮਾਨ ਘੁਮਾਂਦੇ ਸੀਗੇ ਜੀ ਅਤੇ ਉਹਤੋਂ ਬਾਅਦ ਉੱਥੇ ਅਸੀਂ ਚਾਰ ਦਿਨ ਰੁਕੇ ਉਹਤੋਂ ਬਾਅਦ ਉੱਥੇ ਦੀ ਇੱਕ ਬਹੁਤ ਫੇਮਸ ਰਾਈਡ ਹੈਗੀ ਹੈ ਜੀ ਜਿਹਨੂੰ ਕੀ ਗੰਡੋਲਾ ਰਾਈਡ ਕਹਿੰਦੇ ਨੇ ਓ ਇੱਕ ਤਰ੍ਹਾਂ ਦੀ ਟਿਮਬਲ ਟਰੇਨ ਹੈ ਜੀ ਉਹਨੂੰ ਉਹਦੇ ਉਹ ਆਪਾਂ ਨੂੰ ਇੱਕ ਪਹਾੜ ਤੋਂ ਦੂਜੇ ਪਹਾੜ 'ਤੇ ਲੈ ਜਾਂਦੀ ਹੈ ਜੋ ਕਿ ਬਹੁਤ ਉੱਚਾਈ 'ਤੇ ਹੁੰਦਾ ਹੈ ਉੱਥੋਂ ਜਿਹੜਾ ਦ੍ਰਿਸ਼ ਦਿਖਦਾ ਹੈ ਨੀਚੇ ਦਾ ਉਹ ਬਹੁਤ ਜਿਵੇਂ ਕਹਿ ਲਓ ਕੀ ਬੱਦਲ ਦਿਖਦੇ ਹੈ ਜ਼ਮੀਨ 'ਤੇ ਜਿਵੇਂ ਬੱਦਲ ਹੁੰਨੇ ਹੈ ਉਦਾਂ ਆਪਾਂ ਨੂੰ ਦਿਖਦਾ ਹੈ ਅਤੇ ਇਹ ਮੇਰਾ ਹੁਣ ਤੱਕ ਦਾ ਬਹੁਤ ਵਧੀਆ ਯਾਤਰਾ ਸੀਗੀ ਮੈਂ ਸੋਚਿਆ ਵੀ ਨੀ ਸੀਗਾ ਕੀ ਕਸ਼ਮੀਰ ਆਪਣੇ ਭਾਰਤ ਦਾ ਜਿਹੜਾ ਹਿੱਸਾ ਹੈ ਉਹ ਐਨਾ ਸੋਹਣਾ ਹੋ ਸਕਦਾ ਹੈ ਪਰ ਉੱਥੋਂ ਜਾਣ ਤੋਂ ਉੱਥੇ ਜਾ ਕੇ ਮੈਨੂੰ ਇਹ ਗੱਲ ਦਾ ਅਹਿਸਾਸ ਹੋਇਆ ਕੀ ਬਾਕੇਈ ਕਸ਼ਮੀਰ ਨੂੰ ਜੰਨਤ ਕਹਿੰਦੇ ਹਨ